ਪੰਜਾਬ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਤਿਉਹਾਰ ਮਨਾਏ ਜਾਂਦੇ ਹਨ ਜਿਵੇਂ ਕਿ ਦਿਵਾਲੀ ਦੁਸਹਿਰਾ ਲੋਹੜੀ ਅਤੇ ਆਪਣੇ ਮਾਤਾ ਦਾ ਤਿਉਹਾਰ ਮਨਾਇਆ ਜਾਂਦਾ ਕਾਫੀ ਤਰ੍ਹਾਂ ਦੇ ਤਿਉਹਾਰ ਨੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਆਪਣੇ ਲੋਹੜੀ ਆ ਜਿਹੜੀ ਇਹਨੂੰ ਸਰ੍ਹੋਂ ਦਾ ਸਾਗ ਮੱਕੀ ਦੀਆਂ ਰੋਟੀਆਂ ਅਤੇ ਆਪਣੇ ਤਿਲਾਂ ਦੀਆਂ ਪਿੰਨੀਆਂ ਰਿਓੜੀਆਂ ਵਗੈਰਾ ਬਣਾਈਆਂ ਜਾਂਦੀਆਂ ਹਨ ਦਿਵਾਲੀ ਆ ਦਿਵਾਲੀ ਨੂੰ ਜਿਸ ਤਰ੍ਹਾਂ ਮਠਿਆਈ ਬਣਦੀ ਆ ਅਤੇ ਆਪਣੇ ਲੱਡੂ ਬਣਦੇ ਨੇ ਅ ਬਾਕੀ ਹੋਰ ਵੀ ਕਈ ਤਰ੍ਹਾਂ ਦੇ ਪਕਵਾਨ ਬਣਾਉਂਦੇ ਆ ਦਿਵਾਲੀ ਨੂੰ ਆਪਣੇ ਮਾਤਾ ਦਾ ਜਦੋਂ ਹੁੰਦਾ ਮੇਲਾ ਇਹਨੂੰ ਗੁਲਗੁਲੇ ਕਚੋਰੀਆਂ ਬਣਾਉਂਦੇ ਨੇ ਆਪਣੇ ਬਸੰਤ ਆਉਂਦੀ ਆ ਬਸੰਤ 'ਤੇ ਆਪਾਂ ਪੀਲੇ ਚੌਲ ਬਣਾਉਂਦੇ ਹਾਂ ਹਰ ਇੱਕ ਧਰਮ ਦੇ ਨਾਲ ਰਿਲੇਟਡ ਹਰ ਇੱਕ ਤਰ੍ਹਾਂ ਦਾ ਖਾਣਾ ਅਲੱਗ ਅਲੱਗ ਬਣਦਾ